ਭੰਗੜੇ ਦੇ ਕੁਛ ਆਮ ਸਟੈਪ ਕੀ ਹੁੰਦੇ ਹਨ ਅਤੇ ਉਹ ਪੰਜਾਬ ਸੱਭਿਆਚਾਰ ਦੇ ਯੋਗਦਾਨ ਅਤੇ ਜਸ਼ਨ ਵਾਲੇ ਸਾਬਤ ਵਿੱਚ ਕਿੰਨੇ ਯੋਗਦਾਨ ਪਾਏ ਜਾਂਦੇ ਹਨ ਭੰਗੜੇ ਦੇ ਕੁਝ ਆਮ ਸਟੈਪ ਵਿੱਚ ਝੂਮਰ ਧਮਾਲ ਡੰਡੀ ਅਤੇ ਮਲਵਈ ਗਿੱਧਾ ਸ਼ਾਮਿਲ ਹੁੰਦੇ ਹਨ ਝੂਮਰ ਇੱਕ ਹੋਲੀ ਅਤੇ ਸ਼ਾਂਤੀ ਸਟੈਪ ਹੈ ਜੋ ਆਮ ਤੌਰ 'ਤੇ ਨਾਚ ਦੀ ਸ਼ੁਰੂਆਤ ਵਿੱਚ ਕੀਤਾ ਜਾਂਦਾ ਧਮਾਲ ਅਤੇ ਅਤੇ ਯੋਗਦਾਨ ਸਟੈਪ ਹੈ ਜੋ ਨਾਚ ਵਿੱਚ ਪੈਦਾ ਕਰਦਾ ਹੈ ਡੰਡੀ ਜੋ ਨਾਚ ਵਾਲੀ ਥਾਂ ਉੱਪਰ ਅਤੇ ਹੇਠਾਂ ਲੈ ਕੇ ਜਾਂਦਾ ਹੈ ਅਤੇ ਬਹੁਤ ਜੋਸ਼ ਬਾਰੇ ਸਟੈਪ ਮਤਲਬ ਗਿੱਧਾ ਆਮ ਤੌਰ 'ਤੇ ਔਰਤਾਂ ਦੁਆਰਾ ਕੀਤਾ ਜਾਂਦਾ ਹੈ ਅਤੇ ਇਸ ਥਾਂ ਇਸ ਨੂੰ ਹੱਥ ਪੈਰ ਦੀ ਤਾਲਮੇਲ ਨਾਚ ਜਾਂਦਾ ਹੈ ਇਹ ਸਾਰੇ ਸਟੈਪ ਪੰਜਾਬੀ ਸੱਭਿਆਚਾਰ ਯੋਗਦਾਰ ਅਤੇ ਜਸ਼ਨ ਵਾਲੇ ਦਾ ਯੋਗਦਾਨ ਪਾਏ ਜਾਂਦੇ ਹਨ ਕਿਉਂਕਿ ਇਹ ਨਾ ਤਾਂ ਨਾਚ ਨੱਚਣ ਵਾਲੇ ਵਿੱਚ ਨਹੀਂ ਸੋ ਦੇਖਣ ਵਾਲੇ ਵਿੱਚ ਵੀ ਉਤਸਾਹ ਅਤੇ ਖੁਸ਼ੀ ਦਾ ਮਾਹੌਲ ਪੈਦਾ ਕਰ ਦਿੰਦਾ ਹੈ ਭੰਗੜਾ ਪੰਜਾਬ ਦੀ ਧਰਤੀ ਨਾਲ ਜੁੜਿਆ ਹੋਇਆ ਹੈ ਅਤੇ ਇਸ ਲਈ ਹਰ ਸਟੈਪ ਵਿੱਚ ਪੰਜਾਬੀ ਲੋਕ ਦੀ ਮਿਹਨਤ ਖੁਸ਼ ਅਤੇ ਏਕਤਾ ਦੀ ਝਲਕ ਦਿਖਾਈ ਦਿੰਦੀ ਹੈ ਇਸ ਲਈ ਇਹ ਸਟੈਪ ਪੰਜਾਬੀ ਸੱਭਿਆਚਾਰ ਦੇ ਜਸ਼ਨ ਵਾਲੇ ਸਭ ਦਰਸਾਏ ਜਾਂਦੇ ਹਨ ਇਸ ਤੋਂ ਹੋਰ ਮਜਦੂਰੀ ਮਜ਼ਦੂਰ ਹੁੰਦੇ ਹਨ